ਨਵ ਜੰਮੇ ਬੱਚੇ ਦੇ ਜਨਮ ਉੱਤੇ ਹਰ ਧਰਮ ਦੇ ਲੋਕਾਂ ਦੀਆਂ ਆਪਣੀਆਂ ਆਪਣੀਆਂ ਰਸਮਾਂ ਹੁੰਦੀਆਂ ਹਨ ਜਿਵੇਂ ਕਿ ਪੰਜਾਬੀ ਲੋਕ ਨਵ ਜੰਮੇ ਬੱਚੇ ਦੀ ਖੁਸ਼ੀ ਮਨਾਉਣ ਲਈ ਲੋਹੜੀ ਦੇ ਪ੍ਰੋਗਰਾਮ ਉੱਤੇ ਇਕੱਠ ਕਰਦੇ ਹਨ ਹਿੰਦੂ ਲੋਕ ਪੂਜਾ ਕਰਵਾਉਂਦੇ ਹਨ ਉਸ ਦਾ ਪਹਿਲਾ ਜਨਮ ਦਿਨ ਬੜੀ ਧੂਮ ਧਾਮ ਨਾਲ਼ ਮਨਾਉਂਦੇ ਹਨ ਹਿੰਦੂ ਜਨੇਊ ਪਾਉਂਦੇ ਹਨ ਨਵ ਬੱਚੇ ਜਨਮੇ ਨੂੰ ਤਾਂ ਜੋ ਉਸਨੂੰ ਬੁਰੀ ਨਜ਼ਰਾਂ ਤੋਂ ਬਚਾਇਆ ਜਾ ਸਕੇ ਕਾਲਾ ਟਿੱਕਾ ਲਾਉਂਦੇ ਹਨ ਹਰ ਪ੍ਰਦੇਸ਼ ਵਿੱਚ ਇਹ ਰਸਮਾਂ ਅਲੱਗ ਅਲੱਗ ਹਨ ਜੋ ਲੋਕ ਆਪਣੇ ਰੀਤੀ ਰਿਵਾਜ਼ਾਂ ਨਾਲ਼ ਮਨਾਉਂਦੇ ਹਨ